ਜਿੱਦਾਂ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੀ ਰਹਿੰਦੀ ਹਾਂ ਜਿਵੇਂ ਕਿ ਨੋਵਲ ਹੈ ਨਾ ਛੋ ਸ਼ੋਟ ਸਟੋਰੀ ਧਾਰਮਿਕ ਕਹਾਣੀਆਂ ਅਤੇ ਕਈ ਗੁਰੂਆਂ 'ਤੇ ਕਹਾਣੀਆਂ ਪਰ ਮੈਂ ਇੱਕ ਕ ਕਿਤਾਬ ਪੜ੍ਹੀ ਜਿਹੜੀ ਕਿ ਮੈਨੂੰ ਬਹੁਤ ਹੀ ਵਧੀਆ ਲੱਗੀ ਉਹਨੇ ਮੈਨੂੰ ਬਹੁਤ ਅੱਜ ਵੀ ਜਦੋਂ ਮੈਂ ਉਸ ਕਿਤਾਬ ਬਾਰੇ ਸੋਚਦੀ ਹਾਂ ਤਾਂ ਮੈਨੂੰ ਬੜਾ ਹੀ ਹਾਸਾ ਆਉਂਦਾ ਹੈ ਇਹ ਕਿਤਾਬ ਇੱਕ ਸੀਗੀ ਇ ਇੱਕ ਇੰਗਲ ਅੰਗਰੇਜ਼ੀ ਕਿਤਾਬ ਸੀ ਏ ਡਰਟੀ ਜੋਬ ਬਾਏ ਕ੍ਰਿਸਟੋਫਰ ਇਹਦੇ ਵਿੱਚ ਉਹ ਇੱਕ ਨਵੀਂ ਜੋਬਸ ਜੋਬ ਜੁਆਇਨ ਕਰਦਾ ਬੰਦਾ ਅਤੇ ਉਹਦੀ ਜੋਬ ਦੇ ਦੌਰਾਨ ਉਹਦੀ ਜ਼ਿੰਦਗੀ 'ਚ ਕੀ ਕੀ ਕਦੇ ਉਹ ਕਦੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋਬ ਦੇ ਦੌਰਾਨ ਉਹਨੂੰ ਕੀ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਉਸ ਬਾਰੇ ਹੈ ਉਹਦੇ 'ਚ ਉਹ ਕਿੰਨੀ ਮੁਸ਼ਕਿਲ ਹੁੰਦੀ ਆ ਉਹਨੂੰ ਦਫਤਰ 'ਚ ਕਿੰਨੀਆਂ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਦੀ ਤਨ ਤਨਖਾਹ ਕਦੇ ਨਹੀਂ ਮਿਲਦੀ ਉਹਨੂੰ ਕਿੰਨੇ ਔਖੇ ਉਹਨੂੰ ਉਹ ਹੋ ਕੇ ਕੰਮ ਪੂਰੇ ਕਰਨੇ ਪੈਂਦੇ ਹਨ ਕਈ ਵਾਰੀ ਉਹਨੂੰ ਸਮਝ ਨਹੀਂ ਲੱਗਦਾ ਇਹ ਕੰਮ ਕਿਵੇਂ ਕਰਨਾ ਹੈ ਕਈ ਵਾਰੀ ਉਹਦੇ ਸਾਥੀ ਇੰਨੇ ਉਹਨੂੰ ਤੰਗ ਪਰੇਸ਼ਾਨ ਕਰਦੇ ਨੇ ਜੋਬ ਦੇ ਦੌਰਾਨ ਇੱਕ ਆਮ ਬੰਦੇ ਦੀ ਜ਼ਿੰਦਗੀ 'ਚ ਜਿਵੇਂ ਨੌਕਰੀ ਕਰਦੇ ਹੋਏ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਵੇਂ ਉਹ ਉਹਨੂੰ ਹੈਂਡਲ ਕਰਦਾ ਹੈ ਕਿਵੇਂ ਉਹ ਉਹਨਾਂ ਮੁਸ਼ਕਿਲਾਂ ਤੋਂ ਬਾਹਰ ਨਿਕਲਦਾ ਹੈ ਇਹ ਸਾਰਾ ਕੁਛ ਇਸ ਕਿਤਾਬ ਵਿੱਚ ਹੈ ਅਤੇ ਕਈ ਵਾਰੀ ਇਹੋ ਜਿਹੀਆਂ ਕੰਡੀਸ਼ਨਾਂ ਹੁੰਦੀਆਂ ਨੇ ਕਿ ਤੁਸੀਂ ਉਸ ਜਦੋਂ ਪੜ੍ਹਦੇ ਆ ਤੁਹਾਨੂੰ ਆਪ ਨਾਲ ਹੱਡ ਬੀਤੀ ਲੱਗਦੀ ਆ ਅਤੇ ਤੁਹਾਨੂੰ ਬੜਾ ਹਾਸਾ ਆਉਂਦਾ ਅਤੇ ਉਹਦੇ ਨਾਲ ਦੇ ਜਿਹੜੇ ਦੋਸਤ ਜਾਂ ਉਹਦੇ ਨਾਲ ਕੰਮ ਕਰਨ ਵਾਲੇ ਸਹਿਕਾਰੀ ਕਰਮਚਾਰੀ ਹੁੰਦੇ ਨੇ ਉਹ ਉਹਨੂੰ ਕਿੰਨਾਂ ਤੰਗ ਪਰੇਸ਼ਾਨ ਕਰਦੇ ਨੇ ਉਹ ਵਿਚਾਰਾ ਕਿੰਨੀਆਂ ਮੁਸ਼ਕਿਲਾਂ ਨਾਲ ਉਹਨਾਂ ਦਾ ਸਾਹਮਣਾ ਕਰਕੇ ਉਹਦੇ ਵਿੱਚੋਂ ਬਾਹਰ ਨਿਕਲਦਾ ਹੈ ਕਿ ਉਹ ਇੰਨੀ ਹੀ ਹਾਸੇ ਵਾਲੀ ਕਿਤਾਬ ਹੈ ਕਿ ਤੁਸੀਂ ਉਹਨੂੰ ਪੜ੍ਹ ਕੇ ਬੜਾ ਹੀ ਲਾਈਟ ਮਹਿਸੂਸ ਕਰਦੇ ਹੋ ਤੁਹਾਨੂੰ ਬੜੀ ਹੀ ਮਤਲਬ ਉਹ ਮਿਲ ਸ਼ਾਂਤੀ ਮਿਲਦੀ ਹੈ ਤੁਸੀਂ ਬੜੇ ਹੀ ਫਰੈਸ਼ ਹੋ ਜਾਂਦੇ ਹੋ ਕਿਤਾਬ ਨੂੰ ਪੜ੍ਹ ਕੇ ਇੱਕ ਸਾਨੂੰ ਇਹੋ ਜਿਹੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਤਾਂ ਕਿ ਆਪਾਂ ਰੋਜ਼ ਦੀਆਂ ਜਿਹੜੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਨੂੰ ਭੁੱਲ ਕੇ ਇੱਕ ਵਾਰ ਆਪਾਂ ਵਧੀਆ ਉਹ ਫਰੈਸ਼ ਹੋ ਜਾਂਦੇ ਹਾਂ